ਸਤਿ ਸ਼੍ਰੀ ਅਕਾਲ ਜੀ ਮੈਂ ਕੁੜਤੀ ਮੰਗਵਾਈ ਸੀਗੀ ਇੱਕ ਮੈਨੂੰ ਸੀਗਾ ਕਿ ਪਤਾ ਨਹੀਂ ਉਹਦਾ ਫਾਈਬਰਿਕ ਕਿੱਦਾਂ ਦਾ ਮਿਲੇਗਾ ਕਿੱਦਾਂ ਦਾ ਨਹੀਂ ਮਿਲੇਗਾ ਮੈਂ ਥੋੜ੍ਹੀ ਕਾਫ਼ੀ ਜ਼ਿਆਦਾ ਮੈਨੂੰ ਸੀਗੀ ਕਿ ਐਕਸਾਈਟਮੈਂਟ ਸੀਗੀ ਕਿ ਹਾਏ ਮੈਂ ਮੈਨੂੰ ਦੇਖਣ 'ਚ ਕੁੜਤੀ ਬਹੁਤ ਵਧੀਆ ਲੱਗੀ ਸੀਗੀ ਮੈਨੂੰ ਮੈਂ ਪਹਿਲੀ ਵਾਰ ਮੰਗਵਾਈ ਸੀਗੀ ਮੈਨੂੰ ਫਾਈਬਰਿਕ ਨੂੰ ਲੈ ਕੇ ਵੀ ਸੀਗੀ ਕਿ ਕਿੱਦਾਂ ਦਾ ਮਿਲੇਗਾ ਕੀ ਹੋਵੇਗਾ ਪਰ ਜਦੋਂ ਉਹ ਕੁੜਤੀ ਘਰ ਆਈ ਨਾ ਮੈਂ ਉਹਦੀ ਪੈਕਜਿੰਗ ਖੋਲੀ ਇੰਨੀ ਸੋਹਣੀ ਕੁੜਤੀ ਉਸ ਤੋਂ ਬਾਅਦ ਉਹਦਾ ਵਰਕ ਇੰਨਾ ਪਿਆਰਾ ਵਰਕ ਸੀਗਾ ਨਾ ਉਹਦਾ ਸ਼ੀਸ਼ਿਆਂ ਦਾ ਵਰਕ ਸੀਗਾ ਅਤੇ ਬਹੁਤ ਪਿਆਰਾ ਵਰਕ ਸੀਗਾ ਅਤੇ ਉਹਦੀ ਫਿਟਿੰਗ ਵੀ ਬੜੀ ਵਧੀਆ ਆਈ ਸੀਗੀ ਮੈਨੂੰ ਅਤੇ ਕੁੜਤੀ ਦਾ ਫਾਈਬਰਿਕ ਬਹੁਤ ਵਧੀਆ ਸੀਗਾ ਅਤੇ ਬਹੁਤ ਸੋਹਣੀ ਕੁੜਤੀ ਸੀਗੀ ਮਤਲਬ ਲੈ ਦੇ ਕੇ ਇੱਕ ਮੇਰਾ ਪ੍ਰੋਡਕਟ ਮੈਨੂੰ ਬਹੁਤ ਵਧੀਆ ਮਿਲਿਆ ਅਤੇ ਮੈਂ ਸੈਟਿਸਫਾਈ ਸੀਗੀ ਅਤੇ ਮੈਨੂੰ ਜਿਹੜਾ ਪ੍ਰੋਡਕਟ ਮਿਲਿਆ ਨਾ ਮੈਂ ਬਹੁਤ ਖੁਸ਼ ਸੀ ਉਹਨੂੰ ਲੈ ਕੇ ਅਤੇ ਜਦੋਂ ਮੈਂ ਉਹਨੂੰ ਪਾਇਆ ਫਿਰ ਸਾਰਿਆਂ ਨੇ ਉਹਨੂੰ ਬਹੁਤ ਸਲਾਇਆ ਕਹਿੰਦੇ ਬਹੁਤ ਸੋਹਣੀ ਆ ਬਹੁਤ ਸੋਹਣੀ ਆ ਮੈਨੂੰ ਕੁੜਤੀ ਵਧੀਆ ਮਿਲੀ ਇਕਦਮ ਅਤੇ ਸਭ ਨੂੰ ਪਸੰਦ ਵੀ ਆਈ ਮੇਰੀ ਕੁੜਤੀ ਮੇਰੇ ਮੇਰੀ ਮੰਮੀ ਵੀ ਕਹਿੰਦੇ ਪਏ ਸੀਗੇ ਕਿ ਪਤਾ ਨਹੀਂ ਨਾ ਮੰਗਵਾ ਨਾ ਮੰਗਵਾ ਕਰਦੇ ਪਏ ਸੀ ਪਰ ਜਦੋਂ ਮੈਂ ਮੰਗਵਾਈ ਨਾ ਫਿਰ ਤਾਂ ਮੇਰੇ ਮੰਮੀ ਕਹਿੰਦੇ ਕਿ ਹੁਣ ਕੱਪੜੇ ਮੰਗਵਾਉਣੇ ਆ ਤਾਂ ਬਸ ਇੱਥੋਂ ਹੀ ਮੰਗਵਾਉਣੇ ਆ